ਮੈਂ ਰੇਡੁਆ ਸੁਣਦਾ ਰਹਿੰਦਾ ਉਸ 'ਤੇ ਸਾਰਾ ਦਿਨ ਪੰਜਾਬੀ ਖ਼ਬਰਾਂ ਚੱਲੀ ਜਾਂਦੀਆਂ ਹਨ ਉਸ ਤੋਂ ਇਲਾਵਾ ਟੀ ਵੀ 'ਤੇ ਟੀ ਵੀ 'ਤੇ ਵੀ ਪੰਜਾਬੀ ਖਬਰਾਂ ਕਾਫ਼ੀ ਆਉਂਦੀਆਂ ਹਨ ਜਿਸ ਵਿੱਚ ਜੀਅ ਨਿਊਂਜ ਪੀ ਟੀ ਸੀ ਨਿਊਂਜ ਏ ਪੀ ਸਾਂਝਾ ਡੀ ਡੀ ਪੰਜਾਬੀ ਚੜ੍ਹਦੀ ਕਲਾ ਜੀ ਪੰਜਾਬੀ ਆਦਿ ਨਿਊਜਾਂ ਆਉਂਦੀਆਂ ਹਨ ਇਹ ਸਾਰੀ ਨਿਊਜਾਂ ਪੰਜਾਬੀ ਵਿੱਚ ਆਉਦੀਆਂ ਹਨ ਔਰ ਮੈਂ ਸਾਰਾ ਦਿਨ ਨਿਊਜ ਹੀ ਸੁਣਦਾ ਹਾਂ ਇਸ ਤੋਂ ਇਲਾਵਾ ਅਖ਼ਬਾਰ ਵਿੱਚ ਅਜੀਤ ਅਜੀਤ ਜਗ ਬਾਣੀ ਪੰਜਾਬੀ ਟ੍ਰਿਬਿਊਨ ਰੋਜ਼ਾਨਾ ਸਪੋਕਸਮੈਨ ਸ਼ੇਰੇ ਪੰਜਾਬ ਟਾਈਮ ਦ ਦਾ ਟ਼੍ਰਿਬਿਊਨ ਆਦਿ ਖਬ਼ਰਾਂ ਮੈਂ ਪੰਜਾਬੀ ਵਿੱਚ ਹੀ ਸੁਣਦਾ ਹਾਂ